ਸਤਿ ਸ਼੍ਰੀ ਅਕਾਲ ਜੀ ਮਿੰਤਰਾਂ ਤੋਂ ਬੋਲਦੇ ਹੋ ਮੈਂ ਤੁਹਾਡੀ ਕੰਪਨੀ ਤੋਂ ਮੇਕਅਪ ਦਾ ਸਮਾਨ ਮੰਗਵਾਇਆ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਉਹਦੀ ਪੈਕ ਪੈਕਿੰਗ ਬਹੁਤ ਅੱਛੀ ਸੀ ਅਤੇ ਉਸਦੀ ਕੁਐਲਿਟੀ ਬਹੁਤ ਅੱਛੀ ਸੀ ਬਾਕੀ ਜਦੋਂ ਮੈਂ ਯੂਜ਼ ਕੀਤਾ ਮੈਨੂੰ ਬੜਾ ਵਧੀਆ ਲੱਗਿਆ ਅਤੇ ਮੈਂ ਅੱਗੇ ਤੋਂ ਤੁਹਾਡੀ ਕੰਪਨੀ ਦਾ ਸਮਾਨ ਮੰਗਵਾਵਾਂਗੀ